ਮੈਂ ਖੇਤੀਬਾੜੀ ਵਿੱਚ ਜ਼ਿਆਦਾ ਬਿਲੋਂਗ ਕਰਦੀ ਹਾਂ ਕਿਉਂਕਿ ਸ਼ੁਰੂ ਤੋਂ ਹੀ ਖੇਤੀਬਾੜੀ ਵਿੱਚ ਬਹੁਤ ਹੀ ਖੇਤੀਬਾੜੀ ਕਰਨ ਦਾ ਬਹੁਤ ਹੀ ਰੁਝਾਨ ਸੀ ਇਸ ਕਰਕੇ ਪਹਿਲਾਂ ਹੱਥੀਂ ਖੇਤੀਬਾੜੀ ਕੀਤੀ ਜਾਂਦੀ ਸੀ ਹੱਥਾਂ ਨਾਲ ਬਰਸੀਮ ਵਗੈਰਾ ਪੱਠੇ ਵਗੈਰਾ ਮੱਝਾਂ ਨੂੰ ਵੱਢੇ ਜਾਂਦੇ ਸਨ ਅਤੇ ਅਤੇ ਬਹੁਤ ਹੀ ਔਖਾ ਅਤੇ ਦੇਰ ਨਾਲ ਕੰਮ ਹੁੰਦਾ ਸੀ ਪਰ ਹੁਣ ਅੱਜਕੱਲ੍ਹ ਦੇ ਜ਼ਮਾਨੇ ਵਿੱਚ ਨਵੀਆਂ ਤਕਨੀਕਾਂ ਨਵੀਆਂ ਮਸ਼ੀਨਾਂ ਟਰੈਕਟਰ ਵਗੈਰਾ ਨਾਲ ਵਹਾਈ ਕਰਨ ਦੇ ਨਾਲ ਟਾਈਮ ਵੀ ਘੱਟ ਲੱਗਦਾ ਹੈ ਅਤੇ ਵਹਾਈ ਵੀ ਜਲਦੀ ਹੋ ਜਾਂਦੀ ਹੈ ਇਸ ਕਰਕੇ ਵਧੀਆ ਮਸ਼ੀਨਾਂ ਆ ਆ ਗਈਆਂ ਹਨ ਅਤੇ ਸ ਸਮੇਂ ਦੇ ਨਾਲ ਨਾਲ ਬਹੁਤ ਹੀ ਮਸ਼ੀਨਰੀ ਆ ਗਈ ਹੈ ਜਿਸਦੇ ਨਾਲ ਖੇਤੀ ਸੌਖੀ ਹੁੰਦੀ ਹੈ ਅਤੇ ਉਸਦੇ ਨਾਲ ਲੋਕਾਂ ਨੂੰ ਵੀ ਬਹੁਤ ਹੀ ਆਸਾਨ ਖੇਤੀ ਕਰਨਾ ਬਹੁਤ ਹੀ ਆਸਾਨ ਹੋ ਗਿਆ ਹੈ